ਹੈਲੋ ਹਾਂਜੀ ਵੀਰ ਹਾਂਜੀ ਹਾਂਜੀ ਹਾਂਜੀ ਹਾਂਜੀ ਵੀਰੇ ਤੁਸੀਂ ਕੌਣ ਠੀਕ ਹੈ ਜੀ ਹਾਂਜੀ ਹਾਂਜੀ ਵੀਰੇ ਠੀਕ ਹਾਂਜੀ ਵੀਰੇ ਆਪਣੇ ਦਸ ਗੁਰੂ ਹੋਏ ਨੇ ਗਿਆਰ੍ਹਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹਨਾਂ ਦੇ ਵਿੱਚ ਉਹਨਾਂ ਦੀ ਦਸੇ ਗੁਰੂਆਂ ਦੀ ਬਾਣੀ ਆਪਣੀ ਦਰਜ ਕੀਤੀ ਹੋਈ ਆ ਅਤੇ ਸਵੇਰੇ ਸ਼ਾਮ ਹਰ ਟਾਈਮ ਆਪਣੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਇਹਨਾਂ ਦੀ ਬਾਣੀ ਪੜ੍ਹੀ ਜਾਂਦੀ ਹੈ ਅਤੇ ਆਮ ਤੌਰ 'ਤੇ ਜ਼ਿਆਦਾਤਰ ਸਵੇਰੇ ਜਪਜੀ ਸਾਹਿਬ ਅਤੇ ਸ਼ਾਮ ਦੇ ਟਾਈਮ ਰਹਿਰਾਸ ਸਾਹਿਬ ਦੀ ਬਾਣੀ ਪੜ੍ਹੀ ਜਾਂਦੀ ਆ ਹੈ ਨਾ ਅਤੇ ਹੋਰ ਜਾਣ ਜਾਣਾ ਤੁਸੀਂ ਤਾਂ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਆਪਣੇ ਇੱਥੇ ਬਹੁਤ ਜ਼ਿਆਦਾ ਮੈਂ ਚਲੋ ਇੱਥੇ ਆਪਣੇ ਪਟਿਆਲੇ ਜ਼ਿਲ੍ਹੇ ਤੋਂ ਹਾਂ ਜਿੱਥੇ ਇੱਥੇ ਆਪਣੇ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਹੈਗੇ ਨੇ ਜਿਹੜੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਦੇ ਵਿੱਚ ਨੇ ਅਤੇ ਇੱਥੇ ਤੁਸੀਂ ਆ ਕੇ ਦੇਖ ਸਕਦੇ ਹੋ ਹੈ ਨਾ ਅਤੇ ਤੁਸੀਂ ਹੋਰ ਪੰਜਾਬ ਦੇ ਵਿੱਚ ਜੇ ਕਿਤੇ ਘੁੰਮਣਾ ਚਾਹੁੰਦੇ ਓਂ ਜਾਣਾ ਚਾਹੁੰਦੇ ਓਂ ਦੇਖਣਾ ਚਾਹੁੰਦੇ ਓਂ ਤਾਂ ਆਪਣੇ ਆਪਣੇ ਹੈਗੇ ਨੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਅਤੇ ਤੁਸੀਂ ਉੱਥੇ ਵੀ ਜਾ ਸਕਦੇ ਓਂ ਉੱਥੇ ਗੋਲਡਨ ਟੈਂਪਲ ਦੇ ਨਾਮ ਤੋਂ ਮਸ਼ਹੂਰ ਹੈ ਸ਼ਾਇਦ ਤੁਹਾਨੂੰ ਪਤਾ ਵੀ ਹੋਵੇਗਾ ਤੁਸੀਂ ਗਏ ਵੀ ਹੋ ਹਾਂ ਸੁਣਿਆ ਹੋਵੇਗਾ ਜ਼ਰੂਰ ਦੇਖਣਾ ਚਾਹੀਦਾ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਸਥਾਨ ਨੇ ਧਾਰਮਿਕ ਅਸਥਾਨ ਨੇ ਤੁਹਾਨੂੰ ਜ਼ਰੂਰ ਜਾਣਾ ਚਾਹੀਦਾ ਆਪਣਾ ਸਿੱਖੀਜ਼ਮ ਪੂਰੇ ਪੰਜਾਬ ਦੇ ਵਿੱਚ ਫੈਲਿਆ ਹੋਇਆ ਹੁਣ ਤਾਂ ਬਾਹਰ ਵੀ ਫੈਲਿਆ ਹੋਇਆ ਪਰ ਤੁਸੀਂ ਮਹਾਰਾਸ਼ਟਰ ਤੋਂ ਠੀਕ ਹੈ ਠੀਕ ਹੈ ਜੀ ਅਤੇ ਆਪਣਾ ਕਦੋਂ ਕੁ ਆਏ ਓਂ ਤੁਸੀਂ ਇੱਥੇ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਕੋਈ ਚੱਕਰ ਨਹੀਂ ਬਾਕੀ ਤੁਸੀਂ ਆਓ ਮਿਲਦੇ ਹਾਂ ਆਪਾਂ ਮਿਲ ਕੇ ਫਿਰ ਹੈ ਨਾ ਜ਼ਰੂਰ ਤੁਹਾਨੂੰ ਕਰਵਾਵਾਂਗੇ ਦਰਸ਼ਨ ਤੁਸੀਂ ਆਓ ਕੋਈ ਨਹੀਂ ਆਪਾਂ ਮਿਲਦੇ ਹਾਂ